ਜੇ ਟੈਕਨੋਲੋਜੀ ਦੇ ਨਾਲ ਸਾਡੇ ਆਉਣ ਜਾਣ ਦੀ ਜਿਹੜੀ ਸੁਵਿਧਾਵਾਂ ਦੇ ਉੱਤੇ ਕੀ ਅਸਰ ਪਿਆ ਉਹਦੀ ਮੈਂ ਗੱਲ ਕਰਾਂ ਹਾਂ ਮੈਂ ਮੰਨਦਾ ਬਹੁਤ ਫ਼ਰਕ ਪਿਆ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਅਤੇ ਜੇ ਕਿਤੇ ਆਉਣਾ ਜਾਣਾ ਟਰੇਨ 'ਚ 'ਤੇ ਸਟੇਸ਼ਨ 'ਤੇ ਦੋ ਦੋ ਘੰਟੇ ਪਹਿਲਾਂ ਜਾ ਕੇ ਬੈਠਣਾ ਪੈ ਜਾਂਦਾ ਸੀ ਏਟ ਲੀਸਟ ਇੱਕ ਘੰਟਾ ਪਹਿਲਾਂ ਤਾਂ ਜਾਣਾ ਹੀ ਪੈਂਦਾ ਸੀ ਕਿਉਂਕਿ ਟ੍ਰੇਨ ਦਾ ਕੁਝ ਨਹੀਂ ਪਤਾ ਔਰ ਬੈਠੇ ਰਹਿੰਦੇ ਸੀ ਟਰੇਨ ਆਪਣੇ ਟਾਈਮ ਤੋਂ ਡੇਢ ਡੇਢ ਦੋ ਦੋ ਘੰਟੇ ਲੇਟ ਆ ਰਹੇ ਪਰ ਸਾਨੂੰ ਪਤਾ ਹੀ ਕੁਛ ਨਹੀਂ ਹੈ ਸਟੇਸ਼ਨ 'ਤੇ ਜਾ ਕੇ ਪੁੱਛਣਾ ਅਨਾਉਂਸਮੈਂਟ ਹੋ ਰਹੀ ਥੋੜ੍ਹੀ ਦੇਰ ਮੇਂ ਆ ਰਹੀ ਹੈ ਪਰ ਅੱਜ ਅਸੀਂ ਬੈਠੇ ਹੈ ਐਪ ਦੇ ਉੱਤੇ ਦੇਖ ਲਈਦਾ ਹੈ ਜਦੋਂ ਟਰੇਨ ਲਾਗੇ ਛਾਗੇ ਦੇ ਸਟੇਸ਼ਨ ਕੋਲ ਹੁੰਦੀ ਆ ਉਦੋਂ ਚੱਲ ਪਈਦਾ ਤਾਂ ਹਾਰਡਲੀ ਪੰਦਰ੍ਹਾਂ ਵੀਹ ਮਿੰਟ ਪਹਿਲਾਂ ਜਾਓ ਅਤੇ ਆਪਣਾ ਆਰਾਮ ਨਾਲ ਜਾ ਕੇ ਟ੍ਰੇਨ 'ਤੇ ਬਹਿ ਜਾਓ ਕੋਈ ਤੁਹਾਨੂੰ ਇੰਤਜ਼ਾਰ ਕਰਨ ਦੀ ਲੋੜ ਨਹੀਂ ਗਰਮੀ ਇੱਦਾਂ ਹੀ ਗੱਲ ਕਰਾਂ ਜਦੋਂ ਮੈਨੂੰ ਯਾਦ ਹੈ ਡਰਾਈਵਿੰਗ ਲਾਈਸੈਂਸ ਮੈਂ ਬਣਵਾਇਆ ਸੀ ਆਪਣਾ ਤੇ ਲੰਬੀਆਂ ਲਾਈਨਾਂ 'ਚ ਬੰਦੇ ਲੱਭੋ ਕੋਈ ਵਾਕਫ਼ ਬਾਹਰ ਯਾਰ ਜਿਹਦੀ ਅੰਦਰ ਸੈਟਿੰਗ ਹੋਵੇ ਵਾਰੀ ਛੇਤੀ ਆ ਜਾਏ ਲਾਈਨ 'ਚ ਨਾ ਲੱਗਣਾ ਪਵੇ ਪਰ ਅੱਜ ਉਹ ਹੀ ਪਰਿਵਾਹਨ ਐਪ ਦੇ ਥਰੂ ਬੜਾ ਕੰਮ ਉੰਨਾ ਹੀ ਸੌਖਾ ਹੈ ਘਰੋਂ ਬੈਠੇ ਅਪਲਾਈ ਕਰੋ ਇੱਕ ਫਿਕਸ ਸਲੋਟ ਲੈ ਲਓ ਉਸ ਟਾਈਮ 'ਤੇ ਜਾਓ ਆਪਣਾ ਟੈਸਟ ਦਿਓ ਤਾਂ ਫਰੀ ਹੋ ਕੇ ਆ ਜਾਓ ਚੀਜ਼ ਤੁਹਾਡੇ ਘਰ ਆਪਣੇ ਆਉ ਮਾਈ ਮੈਂ ਪਿੱਛੇ ਆਪਣਾ ਡਰਾਈਵਿੰਗ ਲਾਈਸੰਸ ਰਿਨਿਊ ਕਰਵਾਇਆ ਅਤੇ ਮੈਨੂੰ ਬੜਾ ਆਰਾਮ ਰਿਹਾ ਮੈਂ ਮਤਲਬ ਘਰ ਬੈਠੇ ਰਿਊਨਲ ਦੀ ਐਪਲੀਕੇਸ਼ਨ ਪਾਈ ਪੈਸੇ ਪੇ ਕੀਤੇ ਹਾਂ ਇੱਕ ਵਾਰ ਜਾਣਾ ਪਿਆ ਸਿਰਫ਼ ਮੈਨੂੰ ਫੋਟੋ ਖਿਚਾਉਣ ਲਈ ਅਤੇ ਉਸ ਤੋਂ ਬਾਅਦ ਆਪੇ ਹੀ ਘਰ ਆ ਗਿਆ ਅੱਗੇ ਨਹੀਂ ਤਾਂ ਕਿੰਨੇ ਧੱਕੇ ਖਾਣੇ ਪੈਂਦੇ ਸੀ ਟਰੇਨਾਂ ਦੀ ਗੱਲ ਹੋ ਗਈ ਬੱਸਾਂ ਦੀ ਗੱਲ ਕਰਾਂ ਹੁਣ ਅੱਗੇ ਬਸ ਸਟੈਂਡ ਜਾਣਾ ਪਹਿਲਾਂ ਜਾ ਕੇ ਇਹਦੇ ਟਾਈਮਿੰਗ ਪੁੱਛੋ ਹਾਂਜੀ ਬਸ ਸਲੀਪਰ ਬੱਸ ਕਿੰਨੇ ਵਜੇ ਜਾਂਦੀ ਹੈ ਦਿੱਲੀ ਜਾਣਾ ਹੁੰਦਾ ਸੀ ਟੈਂਸ਼ਨ ਹੀ ਪਈ ਰਹਿੰਦੀ ਸੀ ਬਸ 'ਚ ਜਾਣਾ ਜਾਂ ਤਾਂ ਨੋਰਮਲ ਬੱਸ 'ਚ ਚਲੇ ਜਾਓ ਰਾਤ ਨੂੰ ਟਰੈਵਲ ਕਰਨਾ 'ਤੇ ਟੈਂਸ਼ਨ ਅੱਜ ਦੀ ਡੇਟ 'ਚ ਮੋਬਾਈਲ ਖੋਲੋ ਬਸ ਦੀ ਟਿਕਟ ਬੁੱਕ ਕਰਵਾ ਲਓ ਸਲੀਪਰ 'ਚ ਆਰਾਮ ਨਾਲ ਜਾ ਕੇ ਆਪਣਾ ਬਹਿ ਜੋ ਬਸ ਟਾਈਮ ਤੁਹਾਨੂੰ ਪਤਾ ਹੀ ਹੈ ਕਿੰਨੇ ਵਜੇ ਘਰਦਿਆਂ ਨੂੰ ਵੀ ਫ਼ਿਕਰ ਨਹੀਂ ਤੁਸੀਂ ਆਪਣਾ ਆਨਲਾਈਨ ਜੀ ਪੀ ਐਸ ਆਨ ਕਰ ਦਓ ਘਰਦਿਆਂ ਨੂੰ ਲੋਕੇਸ਼ਨ ਤੁਹਾਡੀ ਮਿਲਦੀ ਵੀ ਕਿੱਥੇ ਜਾ ਰਹੇ ਹੋ ਇਹ ਚੀਜ਼ ਹੈ